ਇੱਕ ਸਫਲ ਸੰਗ੍ਰਹਿ ਲਈ ਕੁਝ ਖਾਸ ਮਾਪਦੰਡ ਜਾਂ ਥੀਮਾਂ ਦੀ ਪਾਲਣਾ ਕਰਨ ਨਾਲ ਮਦਦ ਮਿਲ ਸਕਦੀ ਹੈ ਇਹ ਇਹ ਰਹੇ ਕੁਝ ਅਮਲ ਸ ਸੰਗ੍ਰਹਿਕ ਭਾਵ ਜਿਵੇਂ ਕਿ ਸਟੈਂਪ ਸਿੱਕੇ ਚਟਾਨ ਤਾਂ ਇਹਨਾਂ ਨੂੰ ਅਸੀਂ ਸੰਗ੍ਰਹਿ ਕਰਨ ਸਮੇਂ ਵਰਤ ਸਕਦੇ ਹਾਂ ਜਿਵੇਂ ਕਿ ਥੀਮਾ ਸਟੈਂਪਾਂ ਹੁੰਦੀਆਂ ਥੀਮਾ ਵਿੱਚ ਇਤਿਹਾਸਿਕ ਘਟਨਾਵਾਂ ਹੋਗੀਆਂ ਮਸ਼ਹੂਰ ਵਿਅਕਤੀਆਂ ਬਾਰੇ ਜਾਣਕਾਰੀ ਹੋ ਗਈ ਕੋਈ ਜਗ੍ਹਾ ਬਾਰੇ ਹੋ ਗਈ ਪਸ਼ੂ ਪੰਛੀ ਹੋ ਗਏ ਫੂਲ ਹੋ ਗਏ ਖੇਡਾਂ ਹੋ ਗਈਆਂ ਇਹ ਸਾਰਾ ਕੁਝ ਸ਼ਾਮਿਲ ਹੁੰਦਾ ਜਿਹਦੇ ਵਿੱਚ ਸਾਰੇ ਇੰਪੋਰਟੈਂਟ ਲੋਕਾਂ ਬਾਰੇ ਦੱਸਿਆ ਜਾਂਦਾ ਸਿੱਕੇ ਦੇਸ਼ ਵਿੱਚ ਕੋਈ ਵੀ ਰਾਜੇ ਮਹਾਰਾਜੇ ਹੁੰਦੇ ਆ ਜਿਹੜੇ ਇਤਿਹਾਸਿਕ ਸਮ ਸਿਮਕਾਲ ਹੁੰਦੇ ਆ ਵੱਖ ਵੱਖ ਤਰਾਂ ਦੇ ਧਾਤ ਹੋ ਗਏ ਇਹਦੇ ਵਿੱਚ ਦੱਸਿਆ ਜਾਂਦਾ ਸਾਰਾ ਕੁਛ ਸਿੱਕਿਆਂ ਦੇ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਸਿੱਕੇ ਯੂਜ ਕੀਤੇ ਜਾਂਦੇ ਸੀ ਉਹਨਾਂ ਬਾਰੇ ਚੱਟਾਨਾਂ ਹੁੰਦੀਆਂ ਭੂਗੋਲਿਕ ਖੇਤਰ ਵਿੱਚ ਕੋਈ ਵੀ ਖਾਸ ਕਿਸਮ ਦੀ ਚੱਟਾਨ ਹੁੰਦੀ ਹੈ ਜਿਵੇਂ ਗਰੈਨਾਈਟ ਖਾਸ ਘਟਨਾਵਾਂ ਜਿਵੇਂ ਕਿ ਅਗਨੀ ਪਹਾੜਾਂ ਦੇ ਚੱਟਾਨਾਂ ਤਾਂ ਚੱਟਾਨਾਂ ਦੇ ਵਿੱਚ ਪੁਰਾਣੇ ਕੋਈ ਵੀ ਜਿਹੜੀਆਂ ਭੂਗੋਲਿਕ ਖੇਤਰਾਂ ਵਿੱਚ ਯੂਜ ਹੁੰਦੀਆਂ ਉਹ ਸਭ ਚੀਜ਼ਾਂ ਬਾਰੇ ਦੱਸਿਆ ਜਾਂਦਾ ਸਟੈਂਪਾਂ ਜਾਂ ਸਿੱਕੇ ਜ਼ਿਆਦਾਤਰ ਪੁਰਾਣੇ ਹੁੰਦੇ ਹਨ ਅਤੇ ਉਹਨਾਂ ਦੀ ਮੂਲ ਜ਼ਿਆਦਾ ਹੁੰਦੀ ਹੈ ਚੱਟਾਨਾਂ ਕਦੇ ਵੀ ਖਾਸ ਜਗ੍ਹਾ ਤੋਂ ਮਿਲਦੀਆਂ ਹਨ ਅਤੇ ਵਿਰਲੇ ਢੰਗ ਨਾਲ ਬਣੀਆਂ ਜਾਂਦੀਆਂ ਸਟੈਂਪਾਂ ਦੀ ਹਾਲਤ ਵਿੱਚ ਹੋਣ ਕਰਕੇ ਕਿਨਾਰਿਆਂ ਦੇ ਸਹੀ ਹੋਣ ਕਰਕੇ ਰੰਗਾਂ ਦੇ ਚਮਕਦਾਰ ਹੋਣ ਕਰਕੇ ਮਸ਼ਹੂਰ ਹੁੰਦੀ ਹੁੰਦੀਆਂ